ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਹਾਂਜੀ ਇਹਦੇ ਵਿੱਚ ਆਪਾਂ ਜਿਵੇਂ ਇੱਕ ਟਰੈਕ ਈਵੈਂਟਸ ਹੁੰਦੇ ਨੇ ਹੈ ਨਾ ਫੀਲਡ ਇਵੈਂਟ ਹੁੰਦੇ ਨੇ ਤੁਹਾਨੂੰ ਕਿਹੜੇ ਵਿੱਚ ਵੱਧ ਦਿਲਚਸਪੀ ਆ ਜੇ ਤਾਂ ਤੁਸੀਂ ਰੇਸਿੰਗ ਕਰਦੇ ਹੋ ਹਾਂ ਜੇ ਤਾਂ ਤੁਸੀਂ ਰੇਸਿੰਗ ਕਰ ਲਉਂਗੇ ਤਾਂ ਰੇਸਿੰਗ ਦੇ ਤੁਹਾਨੂੰ ਪਤਾ ਇੱਕ ਤਾਂ ਸਪ੍ਰਿੰਟ ਹੁੰਦੀਆਂ ਨੇ ਇੱਕ ਲੋਂਗ ਰਨਿੰਗ ਹੁੰਦੀਆਂ ਨੇ ਹੈ ਨਾ ਜਿਵੇਂ ਪੰਦਰ੍ਹਾਂ ਸੌ ਸੌਲ਼੍ਹਾਂ ਸੌ ਇਹੀ ਹੁੰਦੀਆਂ ਨੇ ਅਥਲੈਟਿਕਸ ਦੇ ਵਿੱਚ ਪੰਦਰ੍ਹਾਂ ਸੌ ਹੁੰਦੀ ਆ ਉਸ ਤੋਂ ਬਾਅਦ ਤਿੰਨ ਹਜ਼ਾਰ ਲੋਂਗ ਰਨਿੰਗ ਦੇ ਵਿੱਚ ਆ ਜਾਂਦੀ ਆ ਤਾਂ ਤੁਸੀਂ ਸ਼ੋਰਟ ਕਰਨੀਆਂ ਨੇ ਦੋ ਸੌ ਚਾਰ ਸੌ ਅੱਠ ਸੌ ਕੋਈ ਵੀ ਕਰ ਸਕਦੇ ਹੋ ਅਤੇ ਜੇ ਅਤੇ ਫੀਲਡ ਈਵੈਂਟਸ ਦੇ ਵਿੱਚ ਤੁਹਾਨੂੰ ਪ੍ਰੈਕਟਿਸ ਦੀ ਲ ਲੋੜ ਵੀ ਜ਼ਿਆਦਾ ਹੁੰਦੀ ਆ ਵੈਸੇ ਹਰ ਇੱਕ ਈਵੈਂਟ ਲਈ ਹੁੰਦੀ ਆ ਅਤੇ ਉਹਦੇ ਵਿੱਚ ਯਾਨੀ ਕਿ ਥੋ ਜਿਵੇਂ ਲੋਂਗ ਜੰਪ ਹਾਈ ਜੰਪ ਤੁਸੀਂ ਕੋਈ ਵੀ ਇਵੈਂਟ ਕਰ ਸਕਦੇ ਹੋ ਅਤੇ ਜੇ ਤੁਸੀਂ ਪ ਉਹਦੇ ਲਈ ਹੈ ਨਾ ਪ੍ਰੈਕਟਿਸ ਕਰਨੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆ ਕੇ ਇੱਥੇ ਨੇੜਲੇ ਗਰਾਊਂਡ ਵਿੱਚ ਬਰਨਾਲੇ ਵਿੱਚ ਕਿਸੇ 'ਚ ਵੀ ਆ ਸਕਦੇ ਆ ਹਾਂਜੀ ਹਾਂਜੀ ਸਾਨੂੰ ਉੱਥੇ ਆ ਕੇ ਕੰਟੈਕਟ ਕਰ ਲਿਓ ਅਸੀਂ ਤੁਹਾਨੂੰ ਦੱਸ ਦਾਂਗੇ ਜੀ ਓਕੇ ਥੈਂਕ ਯੂ ਵੈਲਕਮ